ਛੇ ਅਕਤੂਬਰ ਦੋ ਹਜ਼ਾਰ ਚਾਰ ਪੰਦਰ੍ਹਾਂ ਅਪ੍ਰੈਲ ਦੋ ਹਜ਼ਾਰ ਤੇਰ੍ਹਾਂ ਪੰਜ ਜਨਵਰੀ ਦੋ ਹਜ਼ਾਰ ਪੰਦਰ੍ਹਾਂ ਇੱਕੀ ਨਵੰਬਰ ਦੋ ਹਜ਼ਾਰ ਅਠਾਰ੍ਹਾਂ ਉਣੱਤੀ ਸਤੰਬਰ ਦੋ ਹਜ਼ਾਰ ਤੇਈ